ਹੈਲੋ ਹਾਂਜੀ ਸਵਿਗੀ ਤੋਂ ਬੋਲ ਰਹੇ ਜੀ ਹਾਂਜੀ ਸਰ ਅਸੀਂ ਸਰ ਤੁਹਾਡੇ ਰੈਸਟੋਰੈਂਟ ਆਉਣਾ ਸੀ ਅਤੇ ਇਸ ਵਾਸਤੇ ਤੁਹਾਨੂੰ ਫੋਨ ਕੀਤਾ ਸੀ ਖਾਣੇ ਦੀ ਸਹੂਲਤ ਬਾਰੇ ਪੁੱਛਣਾ ਸੀ ਵੀ ਖਾਣੇ ਦੇ ਵਿੱਚ ਕਿਹੜੀ ਕਿਹੜੀ ਡਿਸ਼ਿਜ਼ ਤੁਹਾਡੇ ਕੋਲ ਹੈਗੀ ਆ ਅਤੇ ਅਸੀਂ ਆਪਣੇ ਪਰਿਵਾਰ ਦੇ ਨਾਲ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਆਉਣਾ ਸੀ ਇਸ ਲਈ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ ਅਸੀਂ ਵੀ ਕਦੋਂ ਤੁਹਾਡਾ ਰੈਸਟੋਰੈਂਟ ਖੁੱਲ੍ਹਦਾ ਵਾ ਅਤੇ ਕਦੋਂ ਬੰਦ ਹੁੰਦਾ ਅਤੇ ਟੇਬਲ ਦੀ ਜਿਹੜੀ ਹੈਗੀ ਆ ਉਹ ਸਾਨੂੰ ਪਹਿਲਾਂ ਬੁੱਕ ਕਰਾਉਣਾ ਪਊਗਾ ਕਿ ਜਦੋਂ ਅਸੀਂ ਆਵਾਂਗੇ ਉਦੋਂ ਮਿਲੇਗਾ ਸਾਨੂੰ ਟੇਬਲ ਅਤੇ ਏ ਸੀ ਵਗੈਰਾ ਦੀ ਤੁਹਾਡੇ ਕੋਲ ਸਹੂਲਤ ਹੈ ਪੂਰੀ ਅਤੇ ਤੁਹਾਡੇ ਸਟਾਫ ਦਾ ਰਵੱਈਆ ਕਿਸ ਤਰ੍ਹਾਂ ਦਾ ਵਾ ਹਾਂ ਅਤੇ ਪਾਰਕਿੰਗ ਵਗੈਰਾ ਬਿਲਕੁਲ ਸਹੀ ਆ ਅਤੇ ਪਾਰਕਿੰਗ ਤੋਂ ਬਾਅਦ ਇਹ ਤਾਂ ਪੁੱਛਣਾ ਸੀ ਵੀ ਸ਼ਾਮਾਂ ਨੂੰ ਰਾਤ ਨੂੰ ਕਿੰਨੇ ਵਜੇ ਤੱਕ ਤੁਸੀਂ ਇਸ ਨੂੰ ਖੁੱਲ੍ਹਾ ਰੱਖ ਸਕਦੇ ਹੋ ਸਾਡੇ ਵਾਸਤੇ ਅਤੇ ਅਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਆ ਕੇ ਅਤੇ ਇੰਜੋਏ ਕਰਨਾ ਚਾਹੁੰਦੇ ਹਾਂ ਪਾਰਟੀ ਕਰਨੀ ਚਾਹੁੰਦਾ